ਹੈਲੋ ਸਰ ਕੀ ਮੇਰੀ ਗੱਲ ਰਾਮ ਟਰੈਵਲਸ ਨਾਲ ਹੋ ਰਹੀ ਹੈ ਮੈਂ ਤੁਹਾਡਾ ਨੈ ਨੰਬਰ ਨੈੱਟ ਤੋਂ ਲਿੱਤਾ ਸੀਗਾ ਅਤੇ ਮੈਂ ਕਿਤੇ ਜਾਣਾ ਚਾਹੁੰਦੀ ਹਾਂ ਵੈਸੇ ਮੇਰੀ ਛੋਟੀ ਯਾਤਰਾ ਹੈਗੀ ਹੈ ਜ਼ਿਆਦਾ ਸਮਾਂ ਨਹੀਂ ਲੱਗੂੰਗਾ ਪੂਰਾ ਦਿਨ ਖਰਾਬ ਨਹੀਂ ਹੋਉਂਗਾ ਇਸ ਲਈ ਮੈਂ ਤੁਹਾਨੂੰ ਫੋਨ ਕੀਤਾ ਹੈ ਸਰ ਮੈਂ ਚੰਡੀਗੜ੍ਹ ਜਾਣਾ ਚਾਹੁੰਦੀ ਹੈ ਜ਼ੀਰਕਪੁਰ ਏਅਰਪੋਰਟ 'ਤੇ ਅਤੇ ਤੁਸੀਂ ਮੈਨੂੰ ਉਸ ਦੇ ਨੈਕਸਟ ਸੰਡੇ ਤੁਸੀਂ ਐਵਲਵਲ ਹੋਉਂਗੇ ਮੈਂ ਮੈਂ ਸਵੇਰੇ ਪੰਜ ਵਜੇ ਇੱਥੋਂ ਤੁਰਨਾ ਹੈ ਰੋਪੜ ਤੋਂ ਅਤੇ ਉੱਥੇ ਮੇਰੀ ਕੋਸ਼ਿਸ ਆਹ ਰਹੇਗੀ ਕਿ ਅਸੀਂ ਸਾਢੇ ਸੱਤ ਵਜੇ ਤੱਕ ਉੱਥੋਂ ਨਿਕਲ ਜਾਈਏ ਕਿਉਂਕਿ ਸਰ ਮੇਰੇ ਭੈਣ ਭਰਾ ਨੇ ਬਾਹਰੋਂ ਆਉਣਾ ਹੈ ਕੈਨੇਡਾ ਤੋਂ ਅਤੇ ਅਸੀਂ ਉਹਨਾਂ ਨੂੰ ਲੈਣ ਜਾਣਾ ਹੈ ਸਰ ਕੀ ਤੁਸੀਂ ਦੱਸ ਸਕਦੇ ਹੋ ਅਸੀਂ ਤਿੰਨ ਜਣੇ ਹੋਉਂਗੇ ਆਉਂਦੇ ਹੋਏ ਅਤੇ ਉਹਨਾਂ ਦਾ ਥੋੜ੍ਹਾ ਜਿਹਾ ਸਮਾਨ ਹੋਉਂਗਾ ਕੀ ਤੁਸੀਂ ਸਾਨੂੰ ਛੱਡ ਕੇ ਆ ਸਕਦੇ ਹੋ ਅਤੇ ਲੈ ਕੇ ਆ ਸਕਦੇ ਹੋ ਅਤੇ ਇਹਦਾ ਟੋਟਲ ਖਰਚਾ ਕੀ ਹੋਉਂਗਾ ਥੈਂਕ ਯੂ